ਮੈਨੂੰ ਆਪਣੇ ਕੰਮਕਾਰ ਦੇ ਨਾਲ ਕੰਮਕਾਰ ਦੇ ਦੌਰਾਨ ਮੈਨੂੰ ਕੁਕਿੰਗ ਦਾ ਜ਼ਿਆਦਾ ਸ਼ੌਂਕ ਤਾਂ ਨਹੀਂ ਹੈ ਪਰ ਇੱਕ ਵਾਰ ਦਾ ਵਾਕਿਆ ਇਹ ਹੈ ਕਿ ਜਿਵੇਂ ਮੈਂ ਆਪਣੇ ਘਰ ਵਿੱਚ ਮੇਰੇ ਵਾਈਫ ਘਰ ਨਹੀਂ ਸੀ ਅਤੇ ਚਾਵਲ ਹੀ ਧਰੇ ਸੀ ਜਿਨ੍ਹਾਂ ਦੇ ਵਿੱਚ ਮੈਂ ਮੈਨੂੰ ਇੰਨਾ ਐਕਸਪੀਰੀਅੰਸ ਨਹੀਂ ਸੀ ਮੈਂ ਸੀਟੀਆਂ ਇੱਕ ਦੀ ਬਜਾਏ ਦੋ ਤਿੰਨ ਲਵਾ ਤੀਆਂ ਅਤੇ ਉਹ ਚੋਲਾਂ ਦਾ ਕੜਾਹ ਬਣ ਗਿਆ ਉਸ ਟਾਈਮ ਬਟ ਮੈਨੂੰ ਹਰ ਇੱਕ ਪਕਵਾਨ ਪਸੰਦ ਹੈ ਬਟ ਸਭ ਤੋਂ ਜ਼ਿਆਦਾ ਮੇਰਾ ਫੇਵਰੇਟ ਬਰਿਆਨੀ ਹੈ ਜੋ ਕਿ ਅੱਜ ਤੱਕ ਮੈਂ ਕਦੀ ਟਰਾਈ ਨਹੀਂ ਕੀਤੀ ਖਾਧੀ ਜ਼ਰੂਰ ਹੈ ਮੇਰੇ ਵਾਈਫ ਬਣਾ ਦਿੰਦੇ ਹਨ ਬਟ ਉਹ ਮੈਂ ਟਰਾਈ ਕਰੂੰਗਾ ਮੁਸ਼ਕਿਲ ਮੇਰੇ ਲਈ ਇਸ ਲਈ ਹੈ ਉਹ ਕਿਉਂਕਿ ਉਹ ਮੈਨੂੰ ਸਵਾਦਿਸ਼ਟ ਬਹੁਤ ਲੱਗਦੀ ਹੈ ਇਸ ਲਈ ਮੇਰੇ ਲਈ ਉਹੀ ਮੁਸ਼ਕਿਲ ਹੈ ਬਾਕੀ ਨੋਰਮਲ ਚੀਜ਼ਾਂ ਤਾਂ ਬਣਾ ਲਈ ਦੀਆਂ ਹਨ ਪੁਸ਼ਕੀ ਬਸ ਉਹੀ ਮੇਰੇ ਲਈ ਮੁਸ਼ਕਿਲ ਕੰਮ ਹੈ ਮੇਰਾ ਉਹੀ ਮੁਸ਼ਕਿਲ ਪਕਵਾਨ ਹੈ